ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਪਠਾਨਕੋਟ ਤੋਂ ਹਰਜੀਤ ਕੌਰ ਬੋਲ ਰਹੀ ਹਾਂ ਜਿਵੇਂ ਕਿ ਸਾਡੀ ਪੰਜਾਬੀ ਭਾਸ਼ਾ ਹੈ ਅਤੇ ਸਾਡੀ ਪੰਜਾਬੀ ਭਾਸ਼ਾ ਸਿਰਫ਼ ਪੰਜਾਬ 'ਚ ਹੀ ਬੋਲੀ ਜਾਂਦੀ ਹੈ ਅਤੇ ਇਸ ਦੀ ਤੁਲਨਾ ਅਸੀਂ ਹਿੰਦੀ ਭਾਸ਼ਾ ਨਾਲ ਵੀ ਕਿਵੇਂ ਕਰ ਸਕਦੇ ਹਾਂ ਜਿਵੇਂ ਕਿ ਇਹ ਸਾਡੇ ਪੰਜਾਬ ਦੀ ਭਾਸ਼ਾ ਹੈ ਇੱਕ ਪਰ ਫਿਰ ਵੀ ਥੋੜ੍ਹੀ ਬਹੁਤ ਇਹ ਭਾਸ਼ਾ ਸਾਡੀ ਮਿਕਸ ਹੋ ਜਾਂਦੀ ਹੈ ਜਿਵੇਂ ਹਿੰਦੀ ਜਿਹੜੀ ਇੱਕ ਦੇਵਨਾਗਰੀ ਹੈ ਅਤੇ ਪੰਜਾਬੀ ਸਾਡੀ ਗੁਰਮੁਖੀ ਲਿੱਪੀ ਹੈ ਅਤੇ ਇਹ ਜਿਵੇਂ ਸਾਡੇ ਪੰਜਾਬ ਦੇ ਵਿੱਚ ਵੀ ਭਾਸ਼ਾ ਜਿਹੜੀਆਂ ਵਾ ਜਿਵੇਂ ਮਾਝਾ ਮਾਲਵਾ ਦੋਆਬਾ ਇਸ ਤਰ੍ਹਾਂ ਦੀਆਂ ਮਤਲਬ ਮਾਝਾ ਮਾਲਵਾ ਦੋਆਬਾ ਤਿੰਨ ਤਿੰਨ ਅਸੀਂ ਜਿਸ ਵੀ ਇਲਾਕੇ 'ਚ ਜਾਵਾਂਗੇ ਉਸ ਤਰ੍ਹਾਂ ਉਸ ਤਰ੍ਹਾਂ ਦੀ ਵੱਖਰੀ ਬੋਲੀ ਬ ਹੋ ਜਾਂਦੀ ਹੈ ਜਿਵੇਂ ਕਿ ਸਾਡੀ ਪੰਜਾਬੀ ਬੋਲੀ ਵਿੱਚ ਵੀ ਅਲੱਗ ਅ ਇਲਾਕਿਆਂ ਦੀ ਅਲੱਗ ਅਲੱਗ ਬੋਲੀ ਹੁੰਦੀ ਹੈ ਫਿਰ ਵੀ ਅਸੀਂ ਜਦੋਂ ਸਾਡੇ ਪੰਜਾਬ ਤੋਂ ਬਾਹਰ ਜੋ ਲੋਕ ਜਾਂਦੇ ਹੈ ਸਾਡੀ ਆਪਣੀ ਭਾਸ਼ਾ ਨੂੰ ਪ੍ਰਫੁੱਲਿਤ ਕਰਦੇ ਹਨ ਅਤੇ ਆਪਣੀ ਭਾਸ਼ਾ ਨੂੰ ਵੀ ਵਧਾਉਣ ਦੀ ਵੀ ਕੋਸ਼ਿਸ਼ ਕਰਦੇ ਹਨ ਅਤੇ ਸਾਡੇ ਪੰਜਾਬ ਦੀ ਭਾਸ਼ਾ 'ਚ ਵੈਸੇ ਤਾਂ ਪੰ ਜਿਹੜੇ ਪੰਜਾਬ ਦੇ ਲੋਕ ਹੈ ਬਾਹਰ ਵੀ ਬੋਲਦੇ ਹਨ ਅਤੇ ਬਾਹਰ ਵੀ ਸਾਡੀ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਅਤੇ ਹਿੰਦੀ ਸਾਡੀ ਇੱਕ ਸਾਡੀ ਰਾਸ਼ਟਰੀ ਭਾਸ਼ਾ ਹੈ ਜੋ ਕਿ ਅਸੀਂ ਜਦੋਂ ਅਸੀਂ ਬੋਲ ਚਾਲ ਲਈ ਗੱਲ ਕਰੀਏ ਤਾਂ ਅਸੀਂ ਹਿੰਦੀ ਭ ਭਾਵੇਂ ਅਸੀਂ ਪੰਜਾਬ 'ਚ ਹੀ ਰਹਿ ਰਹੇ ਹਾਂ ਫਿਰ ਵੀ ਅਸੀਂ ਜੋ ਕੋਈ ਸਾਡੇ ਨਾਲ ਗੱਲ ਕਰੇਗਾ ਅਸੀਂ ਹਿੰਦੀ 'ਚ ਵੀ ਅਸੀਂ ਗੱਲ ਕਰ ਲੈਂਦੇ ਹੈ ਕਿਉਂਕਿ ਹਿੰਦੀ ਪੰਜਾਬੀ ਅਸੀਂ ਭਾਸ਼ਾ ਦੋਨੇਂ ਹੀ ਜਾਣਦੇ ਹਾਂ ਪਰ ਪੰਜਾਬੀ ਸਾਡੀ ਪੰਜਾਬ ਦੀ ਭਾਸ਼ਾ ਹੈ ਜੋ ਕਿ ਅਸੀਂ ਅ ਅੱਛੇ ਤਰੀਕੇ ਨਾਲ ਜਾਣਦੇ ਹਾਂ ਅਸੀਂ ਅੱਛੇ ਤਰੀਕੇ ਨਾਲ ਬੋਲ ਸਕਦੇ ਹਾਂ